ਪੌਦੇ ਉਗਾਉਣ ਲਈ ਅਸੀਂ ਵਧੀਆ ਉਪਜਾਊ ਮਿੱਟੀ ਵਰਤਦੇ ਹਾਂ ਜਿਵੇਂ ਕਿ ਅੱਛੀ ਮਿੱਟੀ ਹੋਣੀ ਚਾਹੀਦੀ ਹੈ ਇਹ ਪੌਦਿਆਂ ਵਿੱਚ ਜਿਹੜੀ ਖਾਦ ਪਾਉਣੀ ਹੈ ਉਹ ਵੀ ਅਸੀਂ ਤਾਂ ਘਰੇ ਬਣਾ ਲੈਂਦੇ ਹਾਂ ਜਿਵੇਂ ਸਬਜ਼ੀਆਂ ਦੇ ਛਿਲਕੇ ਹੋ ਗਏ ਪੱਤੇ ਹੋ ਗਏ ਅਤੇ ਉਹਨਾਂ ਦਾ ਸਾਰਿਆਂ ਨੂੰ ਉਹ ਕਰਕੇ ਇੱਕ ਭਾਂਡੇ ਵਿੱਚ ਪਾ ਕੇ ਨਾ ਉਹਦਾ ਖਾਦ ਬਣਾ ਲੈਂਦੇ ਹਾਂ ਉਹ ਸਾਰੀ ਖਾਦ ਫਿਰ ਪੌਦਿਆਂ ਵਿੱਚ ਪਾ ਦਿੰਦੇ ਹਾਂ ਅਤੇ ਵਧੀਆ ਪੌਦੇ ਵਧੀਆ ਹੋ ਜਾਂਦੇ ਹੈ ਅਤੇ ਘਰੇ ਬਣਾ ਕੇ ਖਾਦ ਵੀ ਵਰਤਦੇ ਹਾਂ ਪੌਦਿਆਂ ਲਈ ਮਿੱਟੀ ਵਧੀਆ ਹੋਣੀ ਚਾਹੀਦੀ ਹੈ ਜ਼ਿਆਦਾ ਰੇਤਲੀ ਵੀ ਨਹੀਂ ਹੋਣੀ ਚਾਹੀਦੀ ਅਤੇ ਦੂਜੀ ਚੀਕਣੀ ਵੀ ਨੀ ਹੋਣੀ ਚਾਹੀਦੀ ਵਧੀਆ ਮਿੱਟੀ ਚਾਹੀਦੀ ਆ ਪੌਦਿਆਂ ਨੂੰ ਉਗਾਉਣ ਲਈ